ਹਾਂਜੀ ਮੈਨੂੰ ਇਹ ਮੌਕਾ ਮਿਲਿਆ ਸੀਗਾ ਜਦੋਂ ਮੈਂ ਆਪਣੇ ਨਾਲ਼ ਦੇ ਦੋਸਤ ਨੂੰ ਡਾਂਸ ਸਿਖਾਇਆ ਸੀਗਾ ਉਹ ਹਰਿਆਣਾ ਤੋਂ ਬਲੌਂਗ ਕਰਦੀ ਸੀਗੀ ਅਤੇ ਉਹਨੂੰ ਪੰਜਾਬੀ ਗਿੱਧਾ ਅਤੇ ਭੰਗੜਾ ਨਹੀਂ ਆਉਂਦਾ ਸੀਗਾ ਅਤੇ ਜਦੋਂ ਸਾਡੇ ਸਕੂਲ ਦੇ ਵਿੱਚ ਫੈਸਟੀਵਲ ਸੀਗਾ ਐਨੂਅਲ ਫੰਕਸ਼ਨ ਸੀਗਾ ਉਦੋਂ ਇਸੀ ਨੇ ਪਾਰਟੀਸੀਪੇਟ ਕਰਨਾ ਸੀਗਾ ਅਤੇ ਉਹਨੂੰ ਇਸ ਚੀਜ਼ ਦੇ ਬਾਰੇ ਕੁਛ ਵੀ ਨੌਲੇਜ ਨਹੀਂ ਸੀਗੀ ਅਤੇ ਮੈਂ ਫਿਰ ਉਹਨੂੰ ਸਟੈਪਸ ਦੱਸੇ ਸੀਗੇ ਕਿ ਕਿੱਦਾਂ ਕਿੱਦਾਂ ਇਹ ਸਟੈਪਸ ਕਰਦੇ ਕਿੱਦਾਂ ਗਿੱਧਾ ਪਾਂਦੇ ਏ ਅਤੇ ਕਿੱਦਾ ਭੰਗੜੇ ਦੇ ਵਿੱਚ ਕਿਹੜੇ ਸਟੈਪਸ ਹੈ ਜਿਹੜੇ ਕਿ ਫੋਲੋ ਕਰਨੇ ਹੁੰਦੇ ਹਨ ਉਹ ਜ਼ਰੂਰੀ ਹੁੰਦੇ ਹਨ ਅਤੇ ਜਦੋਂ ਉਹਨੇ ਗਿੱਧਾ ਅਤੇ ਭੰਗੜਾ ਸਿੱਖ ਲਿਆ ਤਾਂ ਉਹਦੇ ਘਰਦੇ ਵੀ ਉਸਨੂੰ ਨੱਚਦੇ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਸਨ